ਹੈਲੋ ਹਾਂਜੀ ਹਾਂਜੀ ਮੈਮ ਤੁਸੀਂ ਕੋਣ ਯੈਸ ਯੈਸ ਮੈਮ ਪਾਸਪੋਰਟ ਆਫਿਸਰ ਬੋਲ ਰਿਹਾ ਹਾਂਜੀ ਮੈਮ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਮੈਮ ਠੀਕ ਹੈ ਜੀ ਮੈਮ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਤਤਕਾਲ 'ਚ ਅਪਲਾਈ ਕਰਨਾ ਚਾਹੁੰਦੇ ਇਹ 'ਚ ਮੈਮ ਦੋ ਵੇਅ ਹੁੰਦੇ ਇਹਦੇ ਅਪਲਾਈ ਕਰਨ ਦੇ ਇੱਕ ਤਾਂ ਤਤਕਾਲ 'ਚ ਹੁੰਦਾ ਜੀ ਅਤੇ ਇੱਕ ਮਤਲਬ ਕਿ ਨੋਰਮਲ ਵੇਅ ਹੁੰਦਾ ਤਤਕਾਲ 'ਚ ਥੋੜ੍ਹਾ ਜਿਹਾ ਆਪਾਂ ਨੂੰ ਵੀ ਜਲਦੀ ਮਿਲ ਜਾਂਦਾ ਜਿੱਦਾਂ ਕਿ ਪੰਦਰਾਂ ਕੁ ਦਿਨ ਦਾ ਪ੍ਰੋਸੈਸ ਹੁੰਦਾ ਜੀ ਤਤਕਾਲ ਦੇ ਵਿੱਚ ਪਾਸਪੋਰਟ ਅਪਲਾਈ ਕਰਨ ਦਾ ਅਤੇ ਜਿਹੜਾ ਆਪਾਂ ਨੋਰਮਲ ਕਰਦੇ ਹਾਂ ਅਪਲਾਈ ਉਹਦਾ ਤੁਹਾਨੂੰ ਵਨ ਮੰਥ ਲੱਗ ਜਾਂਦਾ ਜੀ ਅਤੇ ਤੁਸੀਂ ਮੈਮ ਇੱਥੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਤਤਕਾਲ ਦੇ ਵਿੱਚ ਠੀਕ ਥੋੜ੍ਹਾ ਜਾ ਫੀਸ ਥੋੜ੍ਹੀ ਐਕਸਟਰਾ ਲੱਗਦੀ ਹੁੰਦੀ ਨੋਰਮਲ ਨਾਲੋਂ ਅਤੇ ਪੇਪਰ ਵਰਕ ਮੈਮ ਸਾਰਾ ਉਹ ਹੀ ਹੁੰਦਾ ਵੀ ਜੋ ਨੋਰਮਲ ਡਾਕੂਮੈਂਟਸ ਮੈਮ ਜਿੱਦਾਂ ਕਹਿਣ ਦਾ ਵੀ ਇੱਕ ਤੁਹਾਡਾ ਬਰਥ ਸਰਟੀਫਿਕੇਟ ਇੱਕ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੋਂ ਦਾ ਰੈਜੀਡੈਂਸ ਹੋਊਗਾ ਜੀ ਠੀਕ ਹੈ ਜੀ ਇੱਕ ਤੁਹਾਡਾ ਸਕੂਲ ਦਾ ਡੀ ਐਮ ਸੀ ਹੋਊਗਾ ਜੀ ਟੈਂਨਥ ਜਾਂ ਪਲੱਸ ਟੂ ਦਾ ਦੋਵਾਂ 'ਚੋਂ ਇੱਕ ਹੋਊਗਾ ਟੈਂਨਥ ਦਾ ਹੋਊਗਾ ਜੀ ਹਾਂਜੀ ਹਾਂਜੀ ਮੈਮ ਇਸ ਟਾਈਮ ਸਿਟੀਜ ਅਵੇਲੇਬਲ ਹੈ ਇੱਕ ਜਲੰਧਰ ਹੈ ਜੀ ਲੁਧਿਆਣਾ ਚੰਡੀਗੜ੍ਹ ਅਤੇ ਇੱਕ ਅੰਮ੍ਰਿਤਸਰ ਸਾਹਿਬ ਜੀ ਹਾਂਜੀ ਹਾਂਜੀ ਮੈਮ ਨਹੀਂ ਨਹੀਂ ਉਹ ਕੋਈ ਇਸ਼ੂ ਨਹੀਂ ਆਊਗਾ ਬਸ ਜਿਹੜੇ ਕਿ ਤੁਹਾਡੇ ਡ ਜ਼ਰੂਰੀ ਡਾਕੂਮੈਂਟਸ ਆ ਵੀ ਹੈ ਨਾ ਵੀ ਜਿੱਥੇ ਤੁਸੀਂ ਹੁਣ ਜੇ ਤੁਸੀਂ ਆਪਣੇ ਜਿੱਥੇ ਰੈਜੀਡੈਂਸ 'ਚ ਰਹਿ ਰਹੇ ਹੋ ਉੱਥੋਂ ਦਾ ਚੱਲੋ ਤੁਹਾਨੂੰ ਅਪਲਾਈ ਕਰਨਾ ਔਖਾ ਔਖਾ ਨਹੀਂ ਹੁੰਦਾ ਜੇ ਤੁਸੀਂ ਅਦਰ ਰੈਜੀਡੈਂਸ 'ਤੇ ਰਹਿ ਰਹੇ ਹੋ ਅਤੇ ਤੁਹਾਡੇ ਡਾਕੂਮੈਂਟ ਕਿਤੇ ਹੋਰ ਪਏ ਤਾਂ ਉਹ ਜਲਦੀ ਮੰਗਵਾ ਲਓ ਇਹ ਕੋਈ ਗੱਲ ਨਹੀਂ ਮੈਮ ਅਸੀਂ ਅਪਲਾਈ ਕਰ ਦਾਂਗੇ ਤਤਕਾਲ 'ਚ ਅਪਲਾਈ ਕਰ ਦਾਂਗੇ ਅਤੇ ਉਹਦੀ ਮੈਮ ਫੀਸ ਥੋੜ੍ਹੀ ਐਕਸਟਰਾ ਲੱਗੂਗੀ ਜੀ ਮੈਮ ਜ਼ਰੂਰ ਅਪਲਾਈ ਕਰ ਦਾਂਗੇ ਅਸੀਂ ਓਕੇ ਮੈਮ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੈਮ